ਹਾਂਜੀ ਮੈਨੂੰ ਡੈਬਿਟ ਕਾਰਡ ਕੈਡਿਟ ਕਾਰਡ ਵੀਜ਼ਾ ਰੁਪਇਆ ਕਾਰਡ ਬਾਰੇ ਪਤਾ ਇਹ ਲੈਣ ਦੇਣ 'ਚ ਬਹੁਤ ਮਦਦ ਕਰਦੇ ਹਨ ਜਿਵੇਂ ਡੈਬਿਟ ਕਾਰਡ ਦੀ ਮੱਦਦ ਨਾਲ ਅਸੀਂ ਟ੍ਰਾਂਜੇਕਸ਼ਨ ਕਰ ਸਕਦੇ ਹਾਂ ਔਨਲਾਇਨ ਸ਼ੋਪਿੰਗ ਕਰ ਸਕਦੇ ਹਾਂ ਏ ਟੀ ਐਮ ਤੋਂ ਪੈਸੇ ਕਢਵਾ ਸਕਦੇ ਹਾਂ ਕਿਸੇ ਵੀ ਸਮੇਂ ਪੈਸੇ ਜੋ ਇਸ ਨਾਲ਼ ਕਢਵਾਏ ਜਾ ਸਕਦੇ ਹਨ ਅਤੇ ਕਿੱਧਰੇ ਵੀ ਕੋਈ ਜਿਵੇਂ ਪੈਟਰੋਲ ਪਵਾਇਆ ਜਾਂ ਕਿੱਧਰੇ ਸ਼ੋਪਿੰਗ ਕੀਤੀ ਹੈ ਤਾਂ ਟੀ ਐਮ ਕਾਰਡ ਦੀ ਮਦਦ ਨਾਲ ਡੈਬਿਟ ਕਾਰਡ ਦੀ ਮਦਦ ਨਾਲ ਅਸੀਂ ਪੈਸੇ ਪੇ ਕਰ ਸਕਦੇ ਹਾਂ ਇਸ ਤਰ੍ਹਾਂ ਹੀ ਰੁਪਏ ਕਾਰਡ ਨਾਲ ਡੋਮੇਸਟਿਕ ਪੇਮੈਂਟਸ ਕਰ ਸਕਦੇ ਹਾਂ ਇੰਡੀਆਂ ਵਿੱਚ ਹੀ ਅਤੇ ਇਹਦੇ ਨਾਲ ਡੇਲੀ ਟ੍ਰਾਂਜੇਕਸ਼ਨਜ਼ 'ਚ ਬਹੁਤ ਮੱਦਦ ਮਿਲਦੀ ਹੈ ਅਤੇ ਟ੍ਰਾਂਜੈਕਸਨ ਫ਼ੀਸ ਵੀ ਬਹੁਤ ਘੱਟ ਲੱਗਦੀ ਹੈ ਅਤੇ ਇਹ ਕਸਟਮਰਸ ਲਈ ਬਹੁਤ ਸਸਤੇ ਪੈਂਦੇ ਹਨ ਅਤੇ ਇਹਦੇ ਨਾਲ਼ ਨਾਲ਼ ਕੈਸ਼ਬੈਕ ਔਫ਼ਰਸ ਵੀ ਮਿਲਦੀਆਂ ਹਨ ਅਤੇ ਲੈਣ ਦੇਣ ਜੋ ਹੈ ਬਹੁਤ ਸੁਰੱਖਿਅਤ ਰਹਿੰਦਾ ਹੈ ਅਤੇ ਕਿਸੇ ਤਰ੍ਹਾਂ ਦੀ ਕੋਈ ਰਿਸਕ ਦੀ ਗੁਜਾਇਸ਼ ਨਹੀਂ ਹੁੰਦੀ ਇਸ ਤੋਂ ਬਿਨਾਂ ਬਹੁਤ ਔਫ਼ਰਜ਼ ਮਿਲਦੀਆਂ ਅਤੇ ਡਿਸਕਾਉਂਟ ਵੀ ਅੱਛਾ ਮਿਲ ਜਾਂਦਾ ਤਾਂ ਇਹ ਕਾਰਡ ਜਿਹੜੇ ਆ ਬਹੁਤ ਅੱਜ ਕੱਲ੍ਹ ਦੇ ਸਮੇਂ ਵਿੱਚ ਬੈਨੀਫੀਸ਼ੀਅਲ ਹੋ ਰਹੇ ਆ ਕਸਟਰਮਰਸ ਦੇ ਲਈ ਇੱਥੇ ਜਿੱਥੇ ਮਤਲਬ ਕੈਸ਼ ਨਹੀਂ ਨਾਲ ਕੈਰੀ ਕਰਨਾ ਪੈਂਦਾ ਅਤੇ ਇਹ ਬਹੁਤ ਜਿਹੜੀ ਹੈ ਇੱਕ ਪੋਜੀਟੀਵ ਪੁਆਇੰਟਸ ਹੈ